ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੌਸਮ ਦੀ ਤਬਦੀਲੀ ਤਕਨੀਕੀ ਸਹਾਇਤਾ ਅਤੇ ਛੋਟੇ ਪੱਧਰ ਦੇ ਕਿਸਾਨਾਂ ਨੂੰ ਸਿਖਲਾਈ ਨਾ ਮਿਲਣਾ ਆਦਿ ਆਦਿ ਜਦੋਂ ਫਸਲਾਂ ਪੱਕ ਜਾਂਦੀਆਂ ਹਨ ਤਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਮੰਡੀ ਤੱਕ ਪਹੁੰਚਾਉਣ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ ਮੰਡੀ ਵਿੱਚ ਕਈ ਕਈ ਚਿਰ ਉਹਨਾਂ ਦੀ ਫਸਲ ਦੀ ਚੁਕਾਈ ਤੁਲਾਈ ਨਹੀਂ ਹੁੰਦੀ ਅਤੇ ਕਈ ਵਾਰ ਮੌਸਮ ਖਰਾਬ ਹੋਣ ਕਰਕੇ ਉਹਨਾਂ ਦੀਆਂ ਕਣਕਾਂ ਝੋਨੇ ਆਦਿ ਖਰਾਬ ਹੋ ਜਾਂਦੇ ਹਨ ਇਸ ਕਰਕੇ ਫਸਲਾਂ ਨੂੰ ਲਿਜਾਉਣਾ ਵੀ ਤਾਂ ਔਖਾ ਹੈ ਉਹਨਾਂ ਦੀ ਫਸਲਾਂ ਦੀ ਚੁਕਾਈ ਸ਼ਹਿਰਾਂ ਤੱਕ ਲਿਜਾਉਣੀ ਮੰਡੀਆਂ ਤੱਕ ਪਹੁੰਚਾਉਣੀ ਪਹੁੰਚਾਉਣ ਵਿੱਚ ਵੀ ਦਿੱਕਤ ਆਉਂਦੀ ਹੈ ਅਤੇ ਇਸ ਕਰਕੇ ਇਹੋ ਹੀ ਕੁਛ ਕਾਰਣ ਆ ਕਿ ਜਿਸ ਕਰਕੇ ਉਹਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡਾਂ ਵਿੱਚ ਜੇ ਉਹਨਾਂ ਦੀਆਂ ਮਸ਼ੀਨਾਂ ਟਰੈਕਟਰ ਵਗੈਰਾ ਖਰਾਬ ਹੋ ਜਾਣ ਤਾਂ ਉਸਨੂੰ ਠੀਕ ਕਰਵਾਉਣ ਵਾਸਤੇ ਵੀ ਉਹਨਾਂ ਨੂੰ ਮਕੈਨਿਕ ਕੋਲ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਜੋ ਕਿ ਇੱਕ ਕਾਫ਼ੀ ਜ਼ੋਖਿਮ ਭਰਿਆ ਕਾਰਣ ਬਣ ਜਾਂਦਾ ਹੈ ਧੰਨਵਾਦ